ਸਾਡੇ ਦੇਸ਼ ਵਿੱਚ ਬਿਜਲੀ ਦੀ ਵਰਤੋਂ ਬਹੁਤ ਜ਼ਿਆਦਾ ਹੋ ਗਈ ਹੈ ਜੋ ਕਿ ਸਾਡਾ ਹਰ ਇੱਕ ਕੰਮ ਆਸਾਨ ਵੀ ਕਰ ਦਿੱਤਾ ਹੈ ਸਾਨੂੰ ਸਾਡੇ ਘਰ ਵਰਤੀ ਜਾਣ ਵਾਲੀ ਜਿਵੇਂ ਕਿ ਛੋਟੀ ਜਿਹੀ ਆਈਟਮ ਹੈ ਪ੍ਰੈੱਸ ਜੋ ਕੀ ਸਾਡੇ ਕੱਪੜਿਆਂ ਵਿੱਚੋਂ ਵੱਟ ਕੱਢਦੀ ਹੈ ਜਿੰਨੇ ਉਸਦੇ ਫਾਇਦੇ ਹਨ ਓਨੇ ਹੀ ਨੁਕਸਾਨ ਹਨ ਜੋ ਕਿ ਅਸੀਂ ਕੱਪੜੇ 'ਤੇ ਜ਼ਿਆਦਾ ਦੇਰ ਰੱਖ ਦੇਈਏ ਉਹ ਕੱਪੜਾ ਵੀ ਸਾੜ ਦਿੰਦੀ ਹੈ ਜਿਸ ਨਾਲ ਅੱਗ ਵੀ ਲੱਗ ਸਕਦੀ ਹੈ ਅਤੇ ਜੇ ਕਦੇ ਕਦਾਰ ਪ੍ਰੈੱਸ ਉੱਤੇ ਪਾਣੀ ਗਿਰ ਜਾਵੇ ਗਲਤੀ ਨਾਲ ਉਹ ਸਾਨੂੰ ਕਰੰਟ ਵੀ ਮਾਰ ਸਕਦੀ ਹੈ ਜੋ ਕਿ ਸਾਡੀ ਜਾਨ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ